ਦੋ ਮਈ ਉੱਨੀ ਸੌ ਚੁਰਾਸੀ ਤਿੰਨ ਸਪਤੰਬਰ ਉੱਨੀ ਸੌ ਬਿਆਸੀ ਦੋ ਮਈ ਪੰਦਰਾਂ ਸੌ ਸੱਠ ਦੋ ਮਾਰਚ ਦੋ ਹਜ਼ਾਰ ਇੱਕ ਬਾਰਾਂ ਦਸੰਬਰ ਦੋ ਹਜ਼ਾਰ ਤੇਈ